ਮੈਂ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ ਜਿਸ ਵਿੱਚ ਕਿ ਮੈਂ ਇੱਕ ਤਾਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਦੂਜਾ ਮੈਂ ਇੱਕ ਚਾਰ ਪਹੀਆ ਵਾਹਨ ਚਲਾ ਸਕਦਾ ਹਾਂ ਜਿਸ ਦਾ ਕਿ ਮੈਨੂੰ ਕਾਫ਼ੀ ਮਾਣ ਹੈ ਕਿਉਂਕਿ ਇਹ ਚਾਰ ਪਹੀਆ ਵਾਹਕ ਵਾਹਨ ਚਲਾ ਕੇ ਮੈਂ ਆਪਣਾ ਰੁਜ਼ਗਾਰ ਪੈਦਾ ਕਰ ਸਕਦਾ ਹਾਂ ਅਤੇ ਆਪਣੀ ਕਮਾਈ ਦਾ ਸਾਧਨ ਵੀ ਇਸ ਨੂੰ ਬਣਾ ਸਕਦਾ ਹਾਂ ਮੈਨੂੰ ਇਸ ਦਾ ਇਹ ਫਾਇਦਾ ਹੈ ਕਿ ਇਹ ਮੇਰਾ ਆਪਣਾ ਕੰਮ ਹੋਵੇਗਾ ਅਤੇ ਮੈਂ ਜਦੋਂ ਚਾਹਾਂ ਜ ਜਿੰਨਾਂ ਚਾਹਾ ਕਮਾਈ ਕਰ ਸਕਦਾ ਹਾਂ ਕਿਉਂਕਿ ਮੇਰਾ ਕਿਸੇ 'ਤੇ ਕੰਟਰੋਲ ਨਹੀਂ ਹੋਵੇਗਾ ਅਤੇ ਮੇਰਾ ਆਪਣੇ ਰਾਹੀਂ ਹੀ ਪੈਸਾ ਕਮਾਇਆ ਜਾ ਸਕੇਗਾ ਕਿਉਂਕਿ ਚਾਰ ਪਹੀਆ ਵਾਹਕ ਦਾ ਅੱਜ ਕੱਲ੍ਹ ਬਹੁਤ ਹੀ ਕਰਾਇਆ ਮਿਲਦਾ ਹੈ ਅਤੇ ਇਹ ਵਧੀਆ ਸਾਧਨ ਹੈ